ਮੈਂ ਆਪਣੇ ਖੇਤਰ ਦੇ ਵਿੱਚ ਅ ਮੌਸਟਲੀ ਜ਼ਿਆਦਾ ਕਰਕੇ ਰੈਸਟੋਰੈਂਟ ਵਗੈਰਾ ਜਾਂ ਢਾਬੇ ਵਗੈਰਾ ਖੋਲ ਸਕਦੇ ਨੇ ਕਿਉਂਕਿ ਇਸਦਾ ਜਿਹੜਾ ਲੋਕ ਨਾ ਅੱਜ ਕੱਲ ਜਿਹੜਾ ਖਾਣਾ ਹੈ ਬਹਾਰ ਤੋਂ ਆਰਡਰ ਕਰਦੇ ਨੇ ਜਾਂ ਕੁਝ ਹੋਰ ਕਰਦੇ ਨੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਤਕਰੀਬਨ ਇਸ ਦਾ ਹੀ ਕੰਮ ਵਧੇਗਾ ਅਤੇ ਜੇਕਰ ਮੈਂ ਮੇਰੀ ਗੱਲ ਕਰੀਏ ਤਾਂ ਮੈਂ ਖੁੱਦ ਆਪਣਾ ਖੁੱਦ ਦਾ ਢਾਬਾ ਬਣਾਉਣਾ ਚਾਹੁੰਦਾ ਹਾਂ ਕਿਉਂਕਿ ਇਸਦੇ ਵਿੱਚ ਅ ਬੰਦਾ ਵਧੀਆ 'ਚ ਗੁਜ਼ਾਰਾ ਕਰ ਸਕਦਾ ਹੈ